ਪੱਚੀ ਨਵੰਬਰ ਦੋ ਹਜ਼ਾਰ ਇੱਕ ਗਿਆਰ੍ਹਾਂ ਦਸੰਬਰ ਦੋ ਹਜ਼ਾਰ ਚਾਰ ਦਸ ਅਕਤੂਬਰ ਦੋ ਹਜ਼ਾਰ ਛੇ ਅੱਠ ਅਕਤੂਬਰ ਦੋ ਹਜ਼ਾਰ ਚਾਰ ਦਸ ਨਵੰਬਰ ਦੋ ਹਜ਼ਾਰ ਪੰਜ